ਸਾਡਾ ਅੰਮ੍ਰਿਤਸਰ ਸ਼ਹਿਰ ਬਹੁਤ ਹੀ ਪੁਰਾਣਾ ਅਤੇ ਬਹੁਤ ਹੀ ਇਤਿਹਾਸਿਕ ਸ਼ਹਿਰ ਹੈ ਪਰ ਕੁਛ ਲੋਕ ਸਾਡੇ ਅੰਮ੍ਰਿਤਸਰ ਸ਼ਹਿਰ ਨੂੰ ਹਜੇ ਵੀ ਬਹੁਤ ਪਿਛੜਿਆ ਅਤੇ ਇਸ ਦੀ ਬੋਲੀ ਨੂੰ ਬਹੁਤ ਹੀ ਮੰਦਾ ਆਖਦੇ ਹਨ ਸਾਡੇ ਅੰਮ੍ਰਿਤਸਰ ਸ਼ਹਿਰ ਅੱਗੇ ਮੁੱਖ ਚੁਣੌਤੀਆਂ ਹਨ ਅਨਇੰਪਲਾਈਮੈਂਟ ਅਤੇ ਸ਼ਿਕਸ਼ਾ ਦਾ ਸੁਧਾਰ ਕਰਨਾ ਸਾਡੇ ਸਿੱਖਿਆ ਦਾ ਸੁਧਾਰ ਅਸੀਂ ਸਕੂਲਾਂ ਨੂੰ ਵਧੀਆ ਤਰੀਕੇ ਨਾਲ ਤਿਆਰ ਕਰਕੇ ਕਰ ਸਕਦੇ ਹਨ ਸ਼ਹਿਰ ਦੇ ਨੇੜੇ ਦੇ ਸਕੂਲ ਤੇ ਸਿਰਫ ਬਹੁਤ ਅ ਅੱਛੇ ਹਨ ਪਰ ਸ ਜਿਹੜੇ ਸ਼ਹਿਰ ਤੋਂ ਕੁਛ ਦੂਰੀ ਦੇ ਸਕੂਲ ਹਨ ਜਿੱਦਾਂ ਕਿ ਪਿੰਡਾਂ ਦੇ ਵਿੱਚ ਸਕੂਲ ਹਨ ਉਨ੍ਹਾਂ ਦੀ ਹਾਲਤ ਬਹੁਤ ਹੀ ਮਾੜੀ ਹੈ ਇੱਕ ਸੌ ਅੱਸੀ ਅੱਸੀ ਬੱਚਿਆਂ ਨੂੰ ਇਕੱਲਾ ਇੱਕ ਇੱਕ ਟੀਚਰ ਪੜ੍ਹਾ ਰਿਹਾ ਉਹ ਵੀ ਟੈਂਪਰਰੀ ਬੇਸ 'ਤੇ ਟੈਂਪਰਰੀ ਬੇਸ 'ਤੇ ਕਹਿਣ ਤੋਂ ਮਤਲਬ ਹੈ ਕਿ ਉਨ੍ਹਾਂ ਦੀ ਦਸ ਹਜ਼ਾਰ ਦੀ ਸੈਲਰੀ ਹੈ ਅਤੇ ਜਿੱਦਣ ਉਹ ਨਹੀਂ ਆਉਂਦੇ ਤਾਂ ਉਨ੍ਹਾਂ ਦੀ ਸੈਲਰੀ ਕੱਟੀ ਜਾਂਦੀ ਹੈ ਤੇਲ ਭਾੜਾ ਸਭ ਉਨ੍ਹਾਂ ਦਾ ਆਪਣਾ ਹੈ ਤੋ ਅਸੀਂ ਇਹੀ ਅਰਜ਼ ਕਰਨਾ ਚਾਹੁੰਦੇ ਹਾਂ ਕਿ ਸਿੱਖਿਆ ਦਾ ਸੁਧਾਰ ਕਰੋ ਤਾਂ ਕਿ ਸਾਡੇ ਸ਼ਹਿਰ ਦੀ ਹਾਲਤ ਵਧੀਆ ਹੋਵੇ ਪਰ ਸਾਡਾ ਸ਼ਹਿਰ ਸਿਰਫ਼ ਸਿੱਖਿਆ ਦੇ ਪੱਖੋਂ ਨਹੀਂ ਵਿੱਚ ਪਿਛੋਕੜ 'ਚ ਪੈ ਰਿਹਾ ਸਾਡਾ ਸ਼ਹਿਰ ਜਿਹੜਾ ਹੈ ਕਿ ਇੱਕ ਕਹਿ ਲਓ ਕਿ ਜਿੱਦਾਂ ਕਿ ਸ ਆਰਥਿਕ ਸਥਿਤੀ ਤੋਂ ਵੀ ਬੜਾ ਪਿਛੋਕੜ ਹੈ ਜਿੱਦਾਂ ਕਿ ਜਦੋਂ ਵੀ ਇੱਕ ਮੀਂਹ ਵਰਦਾ ਹੈ ਤਾਂ ਸਾਡੇ ਸ਼ਹਿਰ ਵਿੱਚ ਇੰਨਾ ਕੁ ਪਾਣੀ ਇਕੱਠਾ ਹੋ ਜਾਂਦਾ ਕਿ ਇਹਨਾਂ ਦਾ ਇਹਦਾ ਕੋਈ ਦੋ ਦੋ ਚਾਰ ਚਾਰ ਸ਼ ਕਈ ਵਾਰ ਤਾਂ ਹੁੰਦਾ ਕਿ ਇੱਕ ਇੱਕ ਦਿਨ ਤੱਕ ਪਾਣੀ ਇਹਦਾ ਹੱਲ ਨਹੀਂ ਹੁੰਦਾ ਮੈਂ ਅਸੀਂ ਅੱਖੀਂ ਅਸੀਂ ਅੱਖੀਂ ਸ਼ਹਿਰ ਵਾਸੀਆਂ ਨੇ ਆਪਣੀ ਅੱਖੀਂ ਵੇਖਿਆ ਹੈ ਕਿ ਟਾਊਨ ਵੱਲ ਇਲਾਕੇ ਵਿੱਚ ਇਹਨਾਂ ਨੇ ਇੱਕ ਸਾਲ ਡੇਢ ਸਾਲ ਤੱਕ ਇਹਨਾਂ ਨੇ ਸਾਰਾ ਸ਼ਹਿਰ ਪੁੱਟੀ ਰੱਖਿਆ ਕਿ ਪਾਣੀ ਇੱਥੇ ਨਹੀਂ ਖਲੋਏਗਾ ਪਰ ਅੱਜ ਦੀ ਡੇਟ ਵਿੱਚ ਫਿਰ ਪਾਣੀ ਉੱਥੇ ਹੀ ਖਲੋਂਦਾ ਹੈ ਪੈਸੇ ਸਾਰੇ ਸਰਕਾਰ ਖਾ ਗਈ ਅਤੇ ਪਾਣੀ ਹਜੇ ਵੀ ਖਲੋਂਦਾ ਕੋਈ ਹੱਲ ਨਹੀਂ ਇਹਦਾ ਅਸੀਂ ਇਹੀ ਗੁਜ਼ਾਰਿਸ਼ ਕੇ ਸ਼ਹਿਰ ਨੂੰ ਚੰਗਾ ਬਣਾਈਏ ਰਲ ਮਿਲ ਕੇ ਬਣਾਈਏ ਅਤੇ ਵਧੀਆ ਬਣਾਈਏ